ਹੈਲੋ ਸਰ ਮੇਰਾ ਨਾਮ ਆ ਜੀ ਸੁਖਪ੍ਰੀਤ ਅਤੇ ਮੈਂ ਨਾ ਇੱਕ ਈਵੈਂਟ ਪਾਰਟੀ ਲਈ ਹੋਲ ਬੁੱਕ ਕਰਵਾਉਣਾ ਸੀ ਬੰਦੇ ਤਾਂ ਜੀ ਸੌ ਕੁ ਹੋ ਜੂਗਾ ਹਾਂਜੀ ਸੌ ਟਾਈਮਿੰਗ ਜੀ ਛੇ ਵਜੇ ਤੋਂ ਬਾਅਦ ਦੀ ਚਾਰ ਕੁ ਘੰਟੇ ਦਾ ਹੋ ਜੂਗਾ ਹਾਂ ਮੈਨਿਊ ਜੀ ਦਾਲ ਮੱਖਣੀ ਕਰ ਲਿਓ ਇੱਕ ਮਲਾਈ ਕੋਫਤਾ ਮਟਰ ਪਨੀਰ ਸ਼ਾਹੀ ਪਨੀਰ ਅਤੇ ਮਿਕਸ ਵੈਜ ਚਾਵਲ ਦਹੀਂ ਰੋਟੀ ਮਿੱਠੇ 'ਚ ਗੁਲਾਬ ਜਾਮਣ ਅਤੇ ਆਈਸਕ੍ਰੀਮ ਰੱਖ ਲਿਓ ਜੀ ਠੀਕ ਹੈ ਜੀ ਐਸਟੀਮੇਟ ਪ੍ਰਈਜ਼ ਕੁਛ ਠੀਕ ਹੈ ਜੀ ਅਤੇ ਡਿਸਕਾਊਂਟ ਠੀਕ ਹੈ ਜੀ ਓਕੇ